ਕਿਸਾਨ ਨੇ ਜਿੱਦਾਂ ਕਿ ਜਾਣਦੇ ਹਾਂ ਕਿਸਾਨਾਂ ਨੇ ਆਪਣੇ ਘਰ ਵਿੱਚ ਕਈ ਤਰ੍ਹਾਂ ਦੇ ਆਪਣੇ ਜਾਨਵਰ ਰੱਖੇ ਹੁੰਦੇ ਹਨ ਜਿਵੇਂ ਕਿ ਇੱਕ ਆਪਾਂ ਲਾ ਲੈਂਦੇ ਹਾਂ ਗਾਂ ਗਾਂ ਇੱਕ ਐਸੋ ਐਸ ਇੱਦਾਂ ਦਾ ਪਸ਼ੂ ਹੈ ਜਿਸ ਦੀ ਟਾਈਮ ਟੂ ਟਾਈਮ ਉਸ ਨੂੰ ਪਾਣੀ ਲਾਇਆ ਜਾਏ ਟਾਈਮ ਟੂ ਟਾਈਮ ਉਹਨੂੰ ਪੱਠੇ ਪਾਏ ਜਾਣ ਟੈਮ ਟੂ ਟੈਮ ਉਸਨੂੰ ਗਦਾਵਾ ਕੀਤਾ ਜਾਵੇ ਅਤੇ ਜਿਸ ਨਾਲ ਉਹ ਤੰਦਰੁਸਤ ਰਹੇ ਅਤੇ ਸਾਨੂੰ ਤੰਦਰੁਸਤ ਵਾਲਾ ਦੁੱਧ ਦੇ ਸਕੇ ਜਿਵੇਂ ਕਿ ਆਪਾਂ ਖਾਦ ਪਾਉਂਦੇ ਹਾਂ ਚੋਕਰ ਫੀਡ ਇਸਦਾ ਟੈਮ ਟੂ ਟੈਮ ਉਸਨੂੰ ਪਾਇਆ ਜਾਵੇ ਨਾਲ ਦੋ ਨਾਲ ਸਾਨੂੰ ਵਧੀਆ ਤੋਂ ਵਧੀਆ ਦੁੱਧ ਦੇਵੇਗੀ ਉਹ ਜਿਸ ਦੇ ਨਾਲ ਇਸ ਚੀਜ਼ ਦਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਸ਼ੂ ਨੂੰ ਜਿਸ ਤਰ੍ਹਾਂ ਦਾ ਅਸੀਂ ਖਿਲਾਵਾਂਗੇ ਉਸ ਤਰ੍ਹਾਂ ਦਾ ਉਹ ਸਾਨੂੰ ਦੁੱਧ ਦੇਵੇਗੀ ਜਿਵੇਂ ਕਿ ਕਿਸਾਨ ਟਾਈਮ ਟੂ ਟਾਈਮ ਉਸਨੂੰ ਆਪਣੇ ਡੋਕਟਰ ਕੋਲ ਵੈਟਨਰੀ ਡੋਕਟਰ ਕੋਲ ਇੰਜੈਕਸ਼ਨ ਲਗਵਾਉਣ ਟਾਈਮ ਟੂ ਟਾਈਮ ਉਸਦੀ ਦੇਖਭਾਲ ਕਰਨ ਅਤੇ ਜਿਵੇਂ ਕਿ ਆਪਾਂ ਗਰਮੀਆਂ ਆ ਜਾਂਦੀਆਂ ਹਨ ਤਾਂ ਉਸਦੀ ਮਤਲਬ ਖਾਣਾ ਪੀਣਾ ਮਤਲਬ ਬੜਾ ਘੱਟ ਜਾਂਦਾ ਹੈ ਕਿਉਂਕਿ ਗਰਮੀ ਵਿੱਚ ਕੋਈ ਵੀ ਹੈ ਉਹ ਘੱਟ ਤੋਂ ਘੱਟ ਖਾਂਦਾ ਹੈ ਅਤੇ ਪਾਣੀ ਵਗੈਰਾ ਉਸਨੂੰ ਟੈਮ ਸਿਰ ਦਿੱਤਾ ਜਾਵੇ ਹਾਂ ਇੱਕ ਗੱਲ ਹੋਰ ਇੱਕ ਅਜਬ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਆਪਣੇ ਜਬ ਪਸ਼ੂਆਂ ਨੂੰ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਬਲੂਅਟੰਨ ਜਿਸਦੀ ਉਸਦੀ ਟਾਈਮ ਟੂ ਟਾਈਮ ਉਸਦੀ ਵੈਕਸੀਨੇਸ਼ਨ ਕਰਵਾਈ ਜਾਵੇ ਟਾਈਮ ਟਾਈਮ ਉਸਨੂੰ ਡੋਕਟਰ ਕੋਲ ਚੈਕ ਕਰਵਾਇਆ ਜਾਵੇ ਜਾਂ ਡੋਕਟਰ ਕੋਲ ਚੈਕ ਕਰਵਾਇਆ ਜਾਵੇ ਜਿਸ ਨੂੰ ਲੈ ਕੇ ਅਸੀਂ ਉਹ ਤਾਂ ਰੋਗ ਤੋਂ ਦੂਰ ਹੋਣ ਅ ਅਸੀਂ ਵੀ ਉਸਤੋਂ ਬਚੀਏ